ਮੇਰੇ ਖੇਤਰ ਵਿੱਚ ਦਸ ਕਿਲੋਮੀਟਰ ਦੀ ਦੂਰੀ 'ਤੇ ਪ੍ਰਾਈਵੇਟ ਹਸਪਤਾਲ ਹਨ ਜਿਨ੍ਹਾਂ ਵਿੱਚ ਪਹੁੰਚਣ ਲਈ ਮਰੀਜ਼ ਅਤੇ ਉਸਦੇ ਸਾਥੀਆਂ ਨੂੰ ਟਰੈਫਿਕ ਸਮੱਸਿਆ ਦਾ ਕਾਫ਼ੀ ਟਰੈਫਿਕ ਸਮੱਸਿਆ ਤੋਂ ਕਾਫ਼ੀ ਪਰੇਸ਼ਾਨੀ ਹੁੰਦੀ ਹੈ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਦੇ ਸੁਵਿਧਾ ਤਾਂ ਚੰਗੀ ਆ ਪਰ ਉਹਨੂੰ ਬਹੁਤ ਜ਼ਿਆਦਾ ਮਹਿੰਗੀਆਂ ਹਨ ਜਿਸ ਕਾਰਨ ਲੋਕ ਉਹ ਸੁਵਿਧਾਵਾਂ ਦਾ ਪੂਰਾ ਫ਼ਾਇਦਾ ਨਹੀਂ ਲੈ ਪਾਉਂਦੇ ਇਸ ਲਈ ਇਸ ਦੇ ਆਸ ਪਾਸ ਅਤੇ ਟਰੈਫਿਕ ਤੋਂ ਅਲੱਗ ਜੂਨ ਹਸਪਤਾਲ ਲਈ ਹੋਣਾ ਚਾਹੀਦਾ ਹੈ ਜਿੱਥੇ ਆਸਾਨੀ ਨਾਲ ਪਹੁੰਚ ਕੇ ਮਰੀਜ਼ ਅਤੇ ਉਸਦੇ ਲੁ ਸਾਥੀ ਆਪਣਾ ਇਲਾਜ ਅਤੇ ਪੈਸਾ ਬਚਾ ਸਕਣ ਇਸ ਦੇ ਲਈ ਸਰਕਾਰ ਨੂੰ ਔਰ ਵੀ ਨਈ ਨਈਆਂ ਸਹੂਲਤਾਂ ਆਪਣੇ ਸਟੇਟ ਵਾਸੀਆਂ ਨੂੰ ਦੇਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਸਰਕਾਰ ਦਾ ਅਤੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਹੈਲਥ ਦੀ ਪ੍ਰੋਬਲਮ ਠੀਕ ਹੋ ਸਕਦੀ ਹੈ